ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਖੇਤੀਬਾੜੀ ਨਾਲ ਸੰਬੰਧਿਤ ਹੀ ਇਸ ਜ਼ਿਲ੍ਹੇ ਦੇ ਲੋਕ ਹਨ ਅਤੇ ਉਹ ਖੇਤੀ ਬੜੀ ਹੀ ਜ਼ਿਆਦਾ ਕਰਦੇ ਹਨ ਜੇਕਰ ਖੇਤੀ ਦੇਖਿਆ ਜਾਵੇ ਤਾਂ ਉਹਨਾਂ ਦੇ ਜ਼ਿਆਦਾ ਉਤਪਾਦਨ ਝੋਨਾ ਕਣਕ ਮੱਕੀ ਆਲੂ ਜਾਂ ਫਿਰ ਗੰਨੇ ਦੀ ਫਸਲ ਇਹੋ ਜਿਹੀਆਂ ਇਹ ਫਸਲਾਂ ਲਈ ਇਥੋਂ ਫਤਿਹਗੜ੍ਹ ਸਾਹਿਬ ਦੀ ਜਿਹੜੀ ਮਿੱਟੀ ਹੈ ਉਹ ਬੜੀ ਇਹ ਲਾਭਦਾਇਕ ਮੰਨੀ ਜਾਂਦੀ ਹੈ ਇਸ ਦੀ ਫਸਲ ਬਹੁਤ ਅੱਛੀ ਹੁੰਦੀ ਹੈ ਅਤੇ ਇਸਦਾ ਇਸਨੂੰ ਜਦੋਂ ਮਾਰਕੀਟ ਵਿੱਚ ਵੇਚਣ ਜਾਣਾ ਹੁੰਦਾ ਹੈ ਤਾਂ ਉਸ ਦੀ ਵੀ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਜਿਵੇਂ ਕਿ ਗੰਨੇ ਮਿੱਲ ਵੀ ਇਸ ਜ਼ਿਲ੍ਹੇ ਦੇ ਵਿੱਚ ਹਨ ਅ ਫ ਮੰਡੀਆਂ ਵੀ ਹਨ ਸਬਜ਼ੀਆਂ ਦਾ ਵੀ ਚਲੋ ਸੰ ਪੈਦਾ ਹੁੰਦਾ ਹੈ ਪਰ ਸਬਜ਼ੀ ਮੰਡੀਆਂ ਵੀ ਇਸ ਜ਼ਿਲ੍ਹੇ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਬਣੀਆਂ ਹੋਈਆਂ ਹਨ ਇਸ ਤੋਂ ਇਲਾਵਾ ਲੋਕ ਪਸ਼ੂ ਦਾ ਵੀ ਕਰਦੇ ਹਨ ਪਸ਼ੂ ਪਾਲਣ ਵੀ ਕਰਦੇ ਹਨ ਵੱਡੇ ਪੱਧਰ 'ਤੇ ਡਾਇਰੀ ਦਾ ਕੰਮ ਵੀ ਕਰਦੇ ਹਨ ਅਤੇ ਇਸ ਲਈ ਇਥੇ ਕੋਈ ਜ਼ਿਆਦਾ ਦੂਰ ਤਾਂ ਨਹੀਂ ਮਿਲਕ ਫੈਡ ਵੀ ਇੱਥੇ ਨੇੜੇ ਹੀ ਬਣਿਆ ਹੋਇਆ ਹੈ ਇਸ ਕਰਕੇ ਹਰ ਇੱਕ ਪਿੰਡ ਦੇ ਵਿੱਚ ਉਹਨਾਂ ਦੀ ਗੱਡੀ ਦੁੱਧ ਇਕੱਠਾ ਕਰਨ ਲਈ ਆਉਂਦੀ ਹੈ ਜਾਂ ਕੋਈ ਹੋਰ ਆਲ਼ੇ ਦੁਆਲ਼ੇ ਦੇ ਘਰਾਂ ਦੇ ਵਿੱਚ ਲੋਕਾਂ ਦੇ ਦੁੱਧ ਵੇਚਣ ਲਈ ਦਿੱਤੇ ਜਾਂਦੇ ਹਨ ਜ਼ਿਆਦਾਤਰ ਖੇਤੀਬਾੜੀ ਦੇ ਨਾਲ ਹੀ ਸੰਬੰਧਿਤ ਇਹ ਜ਼ਿਲ੍ਹਾ ਮੰਨਿਆ ਜਾਂਦਾ ਹੈ